ਬਿਜਲੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਅਸਮਾਨੀ ਬਿਜਲੀ ਜੋ ਕਿ ਕਿਸੇ ਅਣਸੁਖਾਵੀਂ ਘਟਨਾ ਦਾ ਕਾਰਨ ਬਣਦੀ ਹੈ ਜਿਸ ਨੂੰ ਕਿਸੇ ਵੀ ਜਗ੍ਹਾ 'ਤੇ ਮੀਂਹ ਅਤੇ ਹਨੇਰੀ ਦੇ ਮੌਸਮ ਵਿੱਚ ਅਸਮਾਨ ਵਿੱਚੋਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਇਹ ਬਹੁਤ ਹੀ ਉੱਚ ਮਿਕਦਾਰ ਵਿੱਚ ਜਿਵੇਂ ਕਿ ਇੱਕ ਲੱਖ ਵੋਲਟ ਤੋਂ ਜ਼ਿਆਦਾ ਵਿੱਚ ਡਿੱਗਦੀ ਹੈ ਅਤੇ ਉਸ ਜਗ੍ਹਾ ਨੂੰ ਬਰਬਾਦ ਕਰ ਦਿੰਦੀ ਹੈ ਦੂਸਰੀ ਬਿਜਲੀ ਇਨਸਾਨ ਦੁਆਰਾ ਬਣਾਈ ਜਾਂਦੀ ਹੈ ਜਿਵੇਂ ਕਿ ਡੈਮਾਂ ਦੁਆਰਾ ਪਰਮਾਣੂ ਊਰਜਾ ਦੁਆਰਾ ਜਾਂ ਸੂਰਜੀ ਪਲਾਂਟਾਂ ਦੁਆਰਾ ਇਸ ਦੀ ਵਰਤੋਂ ਦੀ ਮਿਕਦਾਰ ਦੋ ਸੌ ਵੀਹ ਵੋਲਟ ਤੋਂ ਲੈ ਕੇ ਦੋ ਸੌ ਪੰਜਾਹ ਵੋਲਟ ਹੁੰਦੀ ਹੈ ਇਸ ਦੇ ਕੁਝ ਖਤਰੇ ਵੀ ਹਨ ਜਿਵੇਂ ਕਿ ਇਸ ਦੀਆਂ ਤਾਰਾਂ ਨੂੰ ਨੰਗੇ ਹੱਥਾਂ ਨਾਲ ਫੜਿਆ ਜਾਵੇ ਤਾਂ ਇਹ ਮੌਤ ਦਾ ਕਾਰਨ ਬਣ ਸਕਦੀ ਹੈ ਜੇਕਰ ਇਸ ਦੀਆਂ ਦੋਨੋਂ ਤਾਰਾਂ ਨਿਊਟਰਲ ਅਤੇ ਫੇਸ ਆਪਸ ਵਿੱਚ ਜੁੜ ਜਾਣ ਅਤੇ ਉਸਦੇ ਦਾਇਰੇ ਵਿੱਚ ਇਨਸਾਨੀ ਸਰੀਰ ਆ ਜਾਵੇ ਤਾਂ ਉਹ ਬੁਰੀ ਤਰ੍ਹਾਂ ਝੁਲਸ ਸਕਦਾ ਹੈ ਇਸ ਤੋਂ ਬਚਣ ਲਈ ਕੁਝ ਕੁ ਤਰੀਕੇ ਹਨ ਜੋ ਕਿ ਬਹੁਤ ਹੀ ਲਾਹੇਵੰਦ ਹਨ ਅਤੇ ਇਹ ਵਰਤਣੇ ਜ਼ਰੂਰੀ ਹਨ ਜਿਵੇਂ ਕਿ ਹੱਥਾਂ ਉੱਪਰ ਰਬੜ ਦੇ ਦਸਤਾਨੇ ਪਾ ਕੇ ਬਿਜਲੀ ਦੀ ਮੁਰੰਮਤ ਦਾ ਕੰਮ ਕਰਨਾ ਚਾਹੀਦਾ ਹੈ ਪੈਰਾਂ ਵਿੱਚ ਰਬੜ ਦੇ ਬੂਟ ਪਾਏ ਹੋਣੇ ਚਾਹੀਦੇ ਹਨ ਅਤੇ ਔਜ਼ਾਰਾਂ ਨੂੰ ਵੀ ਚੰਗੀ ਤਰ੍ਹਾਂ ਰਬੜ ਦੀ ਤਹਿ ਚੜ੍ਹੀ ਹੋਣੀ ਚਾਹੀਦੀ ਹੈ ਬਿਜਲੀ ਦੇ ਝਟਕੇ ਤੋਂ ਬਚਣ ਦਾ ਇੱਕ ਇਹੀ ਤਰੀਕਾ ਹੈ ਕਿ ਬਿਜਲੀ ਦਾ ਕਰੰਟ ਇਨਸਾਨੀ ਸਰੀਰ ਨੂੰ ਨਾ ਲੱਗੇ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਧੰਨਵਾਦ